ਪੁਰਾਣੇ ਗੀਤਾਂ ਅਤੇ ਅੱਜ ਦੇ ਗੀਤਾਂ ਵਿੱਚ ਬਹੁਤ ਜ਼ਿਆਦਾ ਫਰਕ ਹੈ ਪੁਰਾਣੇ ਸਮੇਂ ਵਿੱਚ ਗੀਤਾਂ ਨੂੰ ਬਿਨਾਂ ਮੈਕ ਤੋਂ ਗਾਇਆ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਨਵੀਆਂ ਨਵੀਆਂ ਤਕਨੀਕਾਂ ਆ ਗਈਆਂ ਹਨ ਇਸ ਨੂੰ ਮੈਕ ਰਾਹੀਂ ਵੀ ਗਾਇਆ ਜਾਂਦਾ ਹੈ ਲੋਕ ਇਸ ਨੂੰ ਵਿਆਹਾਂ ਸ਼ਾਦੀਆਂ ਅਤੇ ਪਾਰਟੀਆਂ ਵਿੱਚ ਵੀ ਵਜਾਉਂਦੇ ਹਨ ਇਹਨਾਂ ਗੀਤਾਂ ਵਿੱਚ ਸਭ ਤੋਂ ਜ਼ਿਆਦਾ ਪੁਰਾਣੇ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਅੱਜ ਦੇ ਜਵਾਕ ਨਵੇਂ ਗੀਤਾਂ ਨੂੰ ਜ਼ਿਆਦਾ ਪਸੰਦ ਕਰਦੇ ਹਨ ਪੁਰਾਣੇ ਗੀਤ ਸਾਡੇ ਬਜ਼ੁਰਗ ਸੁਣਦੇ ਸੀ ਪਰ ਅੱਜ ਦੇ ਗੀਤ ਸਾਡੇ ਅੱਜ ਕੱਲ੍ਹ ਦੇ ਨਵੇਂ ਮੁੰਡੇ ਸੁਣਦੇ ਹਨ ਫਰਕ ਸਿਰਫ ਐਨਾ ਹੈ ਕਿ ਪੁਰਾਣੇ ਗੀਤਾਂ ਲ ਨੂੰ ਰਿਪੀਟ ਕਰਨ ਲਈ ਮਾੜਾ ਮੋਟਾ ਮਿਊਜ਼ਿਕ ਹੁੰਦਾ ਸੀ ਪਰ ਅੱਜ ਦੇ ਸਮੇਂ ਵਿੱਚ ਨਵੇਂ ਗੀਤਾਂ ਨੂੰ ਰਿਪੀਟ ਕਰਨ ਲਈ ਨਵੇਂ ਤੋਂ ਨਵੇਂ ਮਿਊਜ਼ਿਕ ਆ ਗਏ ਹਨ ਜਿਨ੍ਹਾਂ ਨਾਲ਼ ਗੀਤ ਗਾਉਣ ਵਿੱਚ ਬਹੁਤ ਹੀ ਸੌਖੀ ਹੁੰਦੀ ਹੈ ਅਤੇ ਬੜੇ ਹੀ ਚੰਗੇ ਢੰਗ ਨਾਲ਼ ਗਾਇਆ ਜਾ ਸਕਦਾ ਹੈ ਗੀਤ ਗਾਉਣ ਵਾਲੇ ਵੀ ਸੁਣ ਕੇ ਹੈਰਾਨ ਹੋ ਜਾਂਦੇ ਹਨ ਇਸ ਤਰ੍ਹਾਂ ਦੇ ਕੁਝ ਨਵੇਂ ਮਿਊਜ਼ਿਕ ਆ ਗਏ ਹਨ ਕਿ ਗੀਤ ਨੂੰ ਬਹੁਤ ਹੀ ਆਸਾਨੀ ਨਾਲ ਰਿਪੀਟ ਕੀਤਾ ਜਾ ਸਕਦਾ ਹੈ ਗੀਤਾਂ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੰਦੇ ਨੂੰ ਸੁਰ ਲਾਉਣਾ ਪੈਂਦਾ ਹੈ ਗੀਤ ਗਾਉਣ ਲਈ ਸਭ ਤੋਂ ਪਹਿਲਾਂ ਬੰਦੇ ਨੂੰ ਚੁਸਤ ਅਤੇ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਵੀ ਕਦੇ ਅਸੀਂ ਸਟੇਜਾਂ 'ਤੇ ਗੀਤ ਗਾਉਂਦੇ ਹਾਂ ਤਾਂ ਲੋਕਾਂ ਲੋਕ ਸਾਡੇ ਵੱਲ ਵੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਹਨ ਅਤੇ ਇਹਨਾਂ ਗੀਤਾਂ ਨੂੰ ਗਾਉਣ ਲਈ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਇਸ ਨੂੰ ਸਿੱਖਣ ਲਈ ਬਹੁਤ ਹੀ ਜ਼ਿਆਦਾ ਸਮਾਂ ਲੱਗਦਾ ਹੈ ਗੀਤ ਹਮੇਸ਼ਾ ਉੱਚੇ ਪੱਧਰ 'ਤੇ ਸੱਭਿਆਚਾਰਿਕ ਹੋਣੇ ਚਾਹੀਦੇ ਹਨ ਗੀਤਾਂ ਨੂੰ ਗਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਉਸ ਨੂੰ ਸਿੱਖਣਾ ਪੈਂਦਾ ਹੈ ਫਿਰ ਜਾ ਕੇ ਗੀਤ ਰਿਪੀਟ ਹੁੰਦੇ ਹਨ ਅੱਜ ਕੱਲ੍ਹ ਦੇ ਜੋ ਗੀਤ ਆ ਰਹੇ ਹਨ ਇਹ ਸਾਡੇ ਸੱਭਿਆਚਾਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੇ ਹਨ ਪੁਰਾਣੇ ਸਮੇਂ ਦੇ ਗੀਤ ਸੀ ਉਹ ਵੀ ਸਾਡੇ ਸੱਭਿਆਚਾਰਿਕ ਨੂੰ ਦਰਸਾਉਂਦੇ ਸੀ ਇਸ ਲਈ ਲੋਕ ਗੀਤ ਵੀ ਹਨ ਜੋ ਪੰਜਾਬ ਵਿੱਚ ਕਿਸੇ ਥਾਵਾਂ 'ਤੇ ਤਿਉਹਾਰਾਂ ਵਿੱਚ ਗਾਏ ਜਾਂਦੇ ਹਨ ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਲੋਕ ਸਟੇਜਾਂ ਅਤੇ ਡੀਜਿਆਂ 'ਤੇ ਸੌਂਗ ਅਤੇ ਗੀਤ ਵਜਾਉਂਦੇ ਹਨ ਇਸ ਕਰਕੇ ਗੀਤਾਂ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਰਹੀ ਹੈ ਪੰਜਾਬ ਵਿੱਚ ਸਭ ਤੋਂ ਵੱਧ ਸਨਮਾਨ ਲੋਕ ਗੀਤਾਂ ਨੂੰ ਦਿੱਤਾ ਗਿਆ ਹੈ ਅੱਜ ਦੇ ਸਮੇਂ ਦੇ ਜੋ ਗਾਣੇ ਆ ਰਹੇ ਹਨ ਉਹਨਾਂ ਵਿੱਚ ਕਈ ਗੀਤਾਂ 'ਤੇ ਰੋਕ ਵੀ ਲਾਈ ਜਾਂਦੀ ਹੈ ਪਰ ਅੱਜ ਦੇ ਸਮੇਂ ਵਿੱਚ ਕੁਝ ਇਹੋ ਜਿਹੇ ਗੀਤ ਵੀ ਹਨ ਜੋ ਸੱਭਿਆਚਾਰਿਕ ਬੋਲੀ ਨੂੰ ਵੀ ਦਰਸਾਉਂਦੇ ਹਨ ਗੀਤ ਹਮੇਸ਼ਾ ਉੱਚੇ ਪੱਧਰ 'ਤੇ ਸੱਭਿਆਚਾਰਿਕ ਹੋਣੇ ਚਾਹੀਦੇ ਹਨ ਪੁਰਾਣੇ ਸਮੇਂ ਵਿੱਚ ਗੀਤਾਂ ਨੂੰ ਕੋਈ ਵੀ ਨਹੀਂ ਪੁੱਛਦਾ ਸੀ ਪਰ ਅੱਜ ਦੇ ਸਮੇਂ ਦੇ ਜੋ ਵੀ ਗੀਤ ਆ ਰਹੇ ਹਨ ਉਹ ਵੱਧ ਤੋਂ ਵੱਧ ਮਨੋਰੰਜਨ ਦਰਸਾਉਂਦੇ ਹਨ ਇਸ ਕਰਕੇ ਗੀਤ ਅਤੇ ਸੰਗੀਤ ਹਮੇਸ਼ਾ ਹੀ ਆਪਣੇ ਸੰਚਾਰ ਨੂੰ ਵਧਾਉਂਦੇ ਹਨ ਪੁਰਾਣੇ ਸਮਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚੋਂ ਕੁਝ ਸਿੰਗਰ ਸੀ ਜੋ ਕਿ ਬਹੁਤ ਹੀ ਵਧੀਆ ਗਾਉਂਦੇ ਸੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਸਰਦੂਲ ਸਿਕੰਦਰ ਅਤੇ ਗੁਰਦਾਸ ਮਾਨ ਇਹ ਪੁਰਾਣੇ ਸਿੰਗਰ ਹੈ ਉਹ ਨੇ ਜਿਨ੍ਹਾਂ ਨੇ ਸੱਭਿਆਚਾਰਿਕ ਬਾਰੇ ਬਹੁਤ ਹੀ ਜ਼ਿਆਦਾ ਗੀਤ ਗਾਏ ਹਨ ਪਰ ਅੱਜ ਦੇ ਸਮੇਂ ਵਿੱਚ ਜੋ ਨਵੇਂ ਸਿੰਗਰ ਆ ਰਹੇ ਹਨ ਉਹ ਸਭ ਉਹ ਸੱਭਿਆਚਾਰਿਕ ਪੰਜਾਬ ਲੋਕ ਗੀਤ ਨੂੰ ਭੁੱਲਦੇ ਜਾ ਰਹੇ ਹਨ ਇਸ ਕਰਕੇ ਪੰਜਾਬ ਦਾ ਸ ਸਭ ਤੋਂ ਮੁੱਖ ਲੋਕ ਗੀਤ ਮੰਨਿਆ ਗਿਆ ਹੈ ਇਹਨਾਂ ਗੀਤਾਂ ਨੂੰ ਆਪਣੇ ਅੰਦਰੋਂ ਨਿਕਲੀ ਆਵਾਜ਼ ਨਾਲ ਵੀ ਕੰਪੇਅਰ ਕੀਤਾ ਜਾਂਦਾ ਹੈ ਤਾਂ ਕਿ ਜੋ ਵੀ ਅੰਦਰੋਂ ਆਵਾਜ਼ ਨਿਕਲਦੀ ਹੈ ਉਸਨੂੰ ਲਿਖ ਕੇ ਇਹ ਗੀਤ ਬਣਾਇਆ ਜਾਂਦਾ ਹੈ ਨਵੇਂ ਸਮੇਂ ਵਿੱਚ ਇਹ ਗੀਤ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਹੋ ਰਹੇ ਹਨ ਪੁਰਾਣੇ ਸਮੇਂ ਵਿੱਚ ਗੀਤਾਂ ਦਾ ਥੋੜ੍ਹਾ ਸਤਿਕਾਰ ਕੀਤਾ ਜਾਂਦਾ ਸੀ ਪਰ ਨਵੇਂ ਸਮੇਂ ਵਿੱਚ ਗੀਤਾਂ ਨੂੰ ਸਭ ਤੋਂ ਜ਼ਿਆਦਾ ਅਧਿਕਾਰ ਮਿਲਿਆ ਹੈ